ਮੈਨੂੰ ਗਾਇਕੀ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਹੈ ਇਹ ਸ਼ੌਕ ਮੈਨੂੰ ਬਚਪਨ ਤੋਂ ਹੀ ਹੈ

ਰੋਜ਼ ਨਾ ਰੋਜ਼ ਗਾਇਕੀ ਕਰਦੀ ਹਾਂ ਇਹ ਸ਼ੌਕ ਮੈਨੂੰ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਜੀ ਤੋਂ ਜਾਗਿਆ ਸੀ ਉਨ੍ਹਾਂ ਦੇ ਗਾਣਿਆਂ ਨੇ ਮੈਨੂੰ ਐਨਾ ਜ਼ਿਆਦਾ ਪ੍ਰੇਰਿਤ ਕੀਤਾ ਕਿ ਮੈਂ ਵੀ ਸੋਚਿਆ ਕਿ ਮੈਂ ਵੀ ਗਾਇਕੀ ਕਰ ਸਕਦੀ ਹਾਂ ਮੈਂ ਬਚਪਨ ਤੋਂ ਹੀ ਬਹੁਤ ਤਰ੍ਹਾਂ ਦੇ ਉਨ੍ਹਾਂ ਦੇ ਗਾਣੇ ਗਾਉਣ ਦਾ ਪਰਿਆਸ ਕਰਦੀ ਰਹੀ ਉਨ੍ਹਾਂ ਦੇ ਗਾਣਿਆਂ ਨੇ ਮੈਨੂੰ ਐਨਾ ਜ਼ਿਆਦਾ ਪ੍ਰੇਰਿਤ ਕੀਤਾ ਕਿ ਮੈਂ ਖੁਦ ਕਈ ਤਰ੍ਹਾਂ ਦੇ ਵਾਕਾਂਸ਼ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਸਕੂਲ ਵਿੱਚ ਪ੍ਰਦਰਸ਼ਿਤ ਕਰਨਾ ਸ਼ੁਰੂ ਕੀਤਾ ਮੈਂ ਇੰਨੇ ਵਧੀਆ ਵਾਕਾਂਸ਼ ਇਕੱਠੇ ਕੀਤੇ ਕਿ ਮੈਂ ਹੌਲੀ ਹੌਲੀ ਕਈ ਤਰ੍ਹਾਂ ਦੇ ਕੋਲਜਾਂ ਵਿੱਚ ਜਾ ਕੇ ਉਨ੍ਹਾਂ ਦਾ ਵਿਆਖਿਆ ਵੀ ਕੀਤੀ ਮੇਰੇ ਗੀਤ ਸੁਣ ਕੇ ਉੱਥੋਂ ਦੇ ਮਾਸਟਰ ਟੀਚਰਸ ਬਹੁਤ ਪ੍ਰਭਾਵਿਤ ਹੋਏ ਜਿਸ ਕਰਕੇ ਮੈਂ ਕਈ ਤਰ੍ਹਾਂ ਦੇ ਵਾਕਾਂਸ਼ ਅਤੇ ਵਿਆਖਿਆ ਨੂੰ ਸ਼ਾਮਿਲ ਕਰਕੇ ਬਹੁਤ ਤਰ੍ਹਾਂ ਦੇ ਗੀਤ ਬਣਾਏ ਇਸ ਕਰਕੇ ਮੈਨੂੰ ਗਾਇਕੀ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਹੈ